ਦੌੜਦੇ ਸਮੇਂ ਸੱਟ ਲੱਗਣ ਦਾ ਅਨੁਭਵ ਅਕਸਰ ਸਹਿਣਸ਼ੀਲ ਹੋ ਸਕਦਾ ਹੈ ਪਰ ਇਹ ਵੀ ਸਿਖਾਉਂਦਾ ਹੈ ਕਿ ਸੁਰੱਖਿਆ ਅਤੇ ਤਿਆਰੀ ਕਿੰਨੀ ਮਹੱਤਵਪੂਰਨ ਹੈ ਮੈਂ ਜਦੋਂ ਵੀ ਇਹ ਤਜ਼ਰਬਾ ਕਰਦਾ ਹਾਂ ਇਹ ਮੈਨੂੰ ਬਹੁਤ ਕੁਝ ਸਿਖਾਉਂਦਾ ਹੈ ਜਿਵੇਂ ਕਿ ਸਹੀ ਤਰੀਕੇ ਨਾਲ ਦੌੜਨ ਧਿਆਨ ਅਤੇ ਸਾਵਧਾਨੀ ਦੀ ਲੋੜ ਇੱਕ ਵਾਰ ਮੈਨੂੰ ਸਵੇਰੇ ਦੌੜਨ ਲਈ ਨਿਕਲਣ ਦੇ ਦੌਰਾਨ ਸੱਟ ਲੱਗ ਗਈ ਸੀ ਜੋ ਕਿ ਮੈਨੂੰ ਯਾਦਗਾਰ ਤਜ਼ਰਬਾ ਬਣ ਗਿਆ ਇਸ ਸਵੇਰ ਦਾ ਮੌਸਮ ਬਹੁਤ ਵਧੀਆ ਸੀ ਅਤੇ ਮੈਂ ਸਵੇਰੇ ਦੀ ਤਾਜ਼ਗੀ ਨੂੰ ਮੈਨੂੰ ਉਤਸ਼ਾਹਿਤ ਕਰਦੇ ਦੇਖ ਕੇ ਬਿਨਾ ਸਿੱਧੀ ਤਿਆਰੀ ਕੀਤੇ ਹੀ ਦੌੜਨਾ ਸ਼ੁਰੂ ਕਰ ਦਿੱਤਾ ਸੜਕ ਉੱਤਰੀ ਚੜ੍ਹਾਈ ਵਾਲੀ ਸੀ ਪਰ ਮੇਰਾ ਸਾਰਾ ਧਿਆਨ ਦੌੜਨ ਦੀ ਗਤੀ 'ਤੇ ਸੀ ਨਾ ਕਿ ਸੜਕ ਦੇ ਹਾਲਾਤਾਂ 'ਤੇ ਮੈਂ ਜ਼ਿਆਦਾ ਪੇਸ਼ਗੀ ਵਾਰਮਅਪ ਵੀ ਨਹੀਂ ਕੀਤਾ ਸੀ ਜੋ ਕਿ ਸਰੀਰ ਨੂੰ ਲੰਬੇ ਦੌੜਨ ਲਈ ਤਿਆਰ ਕਰਨ ਲਈ ਮਹੱਤਵਪੂਰਨ ਹੁੰਦਾ ਹੈ ਇਸ ਤੋਂ ਬਾਅਦ ਕੁਝ ਮੀਟਰ ਦੌੜਨ ਦੇ ਬਾਅਦ ਮੇਰੇ ਪੈਰ ਨੇ ਸੜਕ ਦੀ ਇੱਕ ਖਰਾਬ ਸਥਿਤੀ ਵਿੱਚ ਦੱਬ ਕੇ ਥੋੜ੍ਹਾ ਮੁੜ ਗਿਆ ਮੇਰੇ ਪੈਰ ਦੇ ਅੰਦਰੋਂ ਇੱਕ ਤਿੱਖੀ ਦਰਦ ਦੀ ਲਹਿਰ ਚੱਲੀ ਅਤੇ ਮੈਂ ਪੈਂਡੂਲਮ ਦੀ ਤਰ੍ਹਾਂ ਆਪਣੀ ਟਿਟ ਨੂੰ ਮੁੜਦਾ ਮਹਿਸੂਸ ਕੀਤਾ ਮੈਂ ਤੁਰੰਤ ਰੁਕਿਆ ਪਰ ਸੱਟ ਦੇ ਕਾਰਨ ਮੈਂ ਪੈਰ ਨੂੰ ਜ਼ਿਆਦਾ ਹਿਲਾ ਨਹੀਂ ਸਕਦਾ ਸੀ ਮੇਰੇ ਦਿਮਾਗ 'ਚ ਇੱਕ ਹੀ ਗੱਲ ਸੀ ਕਿ ਮੈਨੂੰ ਇਹ ਸਿੱਖਣ ਦੀ ਲੋੜ ਹੈ ਕਿ ਕਿਵੇਂ ਸੁਰੱਖਿਅਤ ਅਤੇ ਸਹੀ ਤਰੀਕੇ ਨਾਲ ਦੌੜਿਆ ਜਾਵੇ